ਯੋਗਾ ਦੀਆਂ ਬਹੁਤ ਸਾਰੀਆਂ ਸ਼ੈਲੀਆਂ ਨੇ ਯੋਗ ਇੱਕ ਸਰੀਰਕ ਕਸ਼ ਕਸਰਤ ਹੈ ਜਿਹਦੇ ਨਾਲ ਆਪਣਾ ਸਰੀਰ ਹੈ ਜਿਹੜਾ ਬਹੁਤ ਵਧੀਆ ਅਤੇ ਸਡੋਲ ਰਹਿੰਦਾ ਗਾ ਇਸ ਨਾਲ ਕੀ ਹੁੰਦਾ ਆਪਣੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਯੋਗ ਨੇ ਜਿਹੜੇ ਬਹੁਤ ਤਰ੍ਹਾਂ ਦੇ ਯੋਗ ਨੇ ਯੋਗਾਂ ਕਲਾਸਾਂ ਵੀ ਅੱਜ ਕੱਲ੍ਹ ਹਲਾ ਹਰ ਇੱਕ ਸ਼ਹਿਰਾਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਤਾਂ ਕਿ ਜਿਹੜੇ ਲੋਕ ਨੇ ਉਹ ਬਿਮਾਰੀਆਂ ਤੋਂ ਰਹਿਤ ਹੋ ਸਕਣ ਯੋਗ ਹੈ ਜਿਹੜੇ ਯੋਗ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਨੇ ਯੋਗ ਨੂੰ ਆਪਾਂ ਇੱਕ ਸਰੀਰਕ ਕਸਰਤ ਦੇ ਤੌਰ 'ਤੇ ਲੈ ਸਕਦੇ ਹਾਂ ਜਿਹੜੇ ਲੋਕ ਜਿੰਮਾਂ ਦੇ ਵਿੱਚ ਜਾ ਕੇ ਵਰਕਆਊਟ ਕਰਦੇ ਨੇਗੇ ਉਹ ਵੀ ਤਾਂ ਇੱਕ ਤਰ੍ਹਾਂ ਦੇ ਯੋਗ ਆਸਣ ਹੀ ਨੇ ਜੇ ਉਹ ਆਪਾਂ ਆਪਣੇ ਸਰੀਰ ਨੂੰ ਮੋਲਡ ਕਰਦੇ ਹਾਂ ਠੀਕ ਹੈ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿੰਮਾਂ 'ਚ ਜਾਂਦੇ ਹੈਗੇ ਤਾਂ ਆਪਾਂ ਇਹ ਸੋਚੀਏ ਵੀ ਆਪਾਂ ਜੇ ਉਹ ਹੀ ਕਸਰਤ ਨੂੰ ਆਪਾਂ ਆਪਣੇ ਘਰ ਕਰੀਏ ਠੀਕ ਹੈ ਨਾਲੇ ਤਾਂ ਆਪਣੇ ਪੈਸਿਆਂ ਦੀ ਬੱਚਤ ਹੋਵੇ ਅਤੇ ਨਾਲ ਕੀ ਹੋਵੇਗਾ ਵੀ ਜਿਹੜਾ ਯੋਗ ਹੈਗਾ ਉਹ ਸੁਬਹਾ ਨਿਰਣੇ ਕਾਲਜੇ ਹੁੰਦਾ ਗਾ ਉੱਠ ਕੇ ਖਾਲੀ ਪੇਟ ਉਹਦੇ ਨਾਲ ਕੀ ਹੈ ਜਦੋਂ ਆਪਾਂ ਖਾਲੀ ਪੇਟ ਕੋਈ ਵੀ ਯੋਗਾ ਕਰਦੀ ਹੈ ਨਾ ਤਾਂ ਉਹਦਾ ਜ਼ਿਆਦਾ ਪ੍ਰਭਾਵ ਪੈਂਦਾ ਆਪਣੀ ਬਾਡੀ 'ਤੇ ਉਹ ਜ਼ਿਆਦਾ ਬੈਨੀਫਿਸ਼ਅਲ ਹੁੰਦਾ ਆਪਣੀ ਬੋਡੀ ਵਾਸਤੇ ਜਿਹੜਾ ਆਪਾਂ ਕੁਛ ਖਾ ਪੀ ਕੇ ਵਰਕਆਊਟ ਕਰਦੇ ਹਾਂ ਓਨਾ ਉਹ ਨਹੀਂ ਵਧੀਆ ਹੁੰਦਾ ਜਿੰਨਾ ਕਿ ਖਾਲੀ ਪੇਟ ਵਾਲਾ ਯੋਗਾ ਆਪਣੇ ਵਾਸਤੇ ਜ਼ਿਆਦਾ ਵਧੀਆ ਹੁੰਦਾ ਹੈਗਾ ਠੀਕ ਹੈ ਹਰ ਇੱਕ ਨੂੰ ਅਲੱਗ ਅਲੱਗ ਐਕਸਰਸਾਈਜ਼ ਹੋਵੇਗੀ ਠੀਕ ਹੈ ਯੋਗਾ ਹੋ ਗਿਆ ਪਸੰਦ ਹੁੰਦਾ ਹੈਗਾ ਜਿਵੇਂ ਮੈਨੂੰ ਯੋਗ ਆਸਣ ਵਧੀਆ ਲੱਗਦਾ ਚੌਂਕੜੀ ਮਾਰ ਕੇ ਬੈਠੋ ਦੋਵੇਂ ਹੱਥ ਆਪਣੀਆਂ ਬਾਹਾਂ ਗੋਡਿਆਂ 'ਤੇ ਰੱਖੋ ਲੰਬਾ ਸਾਹ ਭਰ ਕੇ ਹੌਲੀ ਹੌਲੀ ਫਿਰ ਉਹਨੂੰ ਛੱਡੋ ਇਹਦੇ ਨਾਲ ਕੀ ਹੋਵੇਗਾ ਤੁਹਾਡਾ ਸਰੀਰ ਹੈ ਜਿਹੜਾ ਪੂਰਾ ਵਧੀਆ ਰਹੂਗਾ ਤੁਹਾਡੇ ਫੇਫੜੇ ਤੰਦਰੁਸਤ ਰਹਿਣਗੇ ਤੁਹਾਡਾ ਲੀਵਰ ਵਧੀਆ ਰਹੂਗਾ ਤੁਹਾਡੀਆਂ ਅੰਤੜੀਆਂ ਵਧੀਆ ਰਹਿਣਗੀਆਂ ਇਸ ਕਰਕੇ ਮੇਰਾ ਯੋਗ ਆਸਣ ਸਭ ਤੋਂ ਫੇਵਰਟ ਯੋਗਾ ਆਸਣ ਹੈਗਾ ਇਸ ਲਈ ਸਾਰਿਆਂ ਨੂੰ ਹੀ ਯੋਗਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਧੰਨਵਾਦ ਜੀ